ਸਤਿ ਸ਼੍ਰੀ ਅਕਾਲ ਜੀ ਤੁਸੀਂ ਪੁੱਛਿਆ ਹੈ ਲਗਾਤਾਰ ਸਕਰੀਨ ਉੱਤੇ ਕੰਮ ਕਰਦੇ ਹੋਏ ਤੁਸੀਂ ਕਿ ਕਦੋਂ ਬੋਰੀਅਤ ਦਾ ਸਾਹਮਣਾ ਕੀਤਾ ਹੈ ਕਦੇ ਹਾਂਜੀ ਬਹੁਤ ਵਾਰ ਸਾਹਮਣਾ ਕੀਤਾ ਹੈ ਬੋਰੀਅਤ ਦਾ ਪਰ ਕੰਮ ਤਾਂ ਕਰਨਾ ਹੀ ਪੈਂਦਾ ਹੈ ਬੋਰੀਅਤ ਦਾ ਸਾਹਮਣਾ ਕਰਦੇ ਹੋਏ ਵੀ ਜੋ ਵੀ ਸਕਰੀਨ 'ਤੇ ਕੰਮ ਕਰਨਾ ਹੁੰਦਾ ਜ਼ਰੂਰੀ ਹੁੰਦਾ ਹੈ ਉਹ ਕਰਨਾ ਹੀ ਪੈਂਦਾ ਹੈ ਕੰਮ ਕਰਦੇ ਹਾਂ ਬੋਰੀਅਤ ਵੀ ਹੁੰਦੀ ਹੈ ਪਰ ਕੰਮ ਕਰਕੇ ਉਸ ਤੋਂ ਬਾਅਦ ਅਸੀਂ ਬੋਰੀਅਤ ਨੂੰ ਦੂਰ ਕਰਨ ਲਈ ਆਪਣਾ ਅਸੀਂ ਇੰਜੋਏ ਕਰਦੇ ਹਾਂ ਕਿ ਥੋੜ੍ਹਾ ਬਾਹਰ ਚੱਲੇ ਜਾਂਦੇ ਹਾਂ ਤਾਜ਼ੀ ਹਵਾ ਵਿੱਚ ਕਿ ਸਾਡਾ ਮਾਇੰਡ ਮਨ ਸ਼ਾਂਤ ਹੋ ਜਾਵੇ ਥੋੜ੍ਹਾ ਜਿਹਾ ਰਿਲੈਕਸ ਹੋ ਜਾਵੇ ਕਿ ਦਿਮਾਗ ਵੀ ਬਹੁਤ ਜ਼ਿਆਦਾ ਥੱਕ ਜਾਂਦਾ ਹੈ ਸਕਰੀਨ 'ਤੇ ਕੰਮ ਕਰਕੇ ਅਤੇ ਬੋਰੀਅਤ ਵੀ ਹੁੰਦੀ ਹੈ ਫਿਰ ਦਿਮਾਗ ਵੀ ਥੱਕ ਜਾਂਦਾ ਹੈ ਇਸ ਕਰਕੇ ਅਸੀਂ ਬੋਰੀਅਤ ਤ ਦਿਮਾਗ ਨੂੰ ਫਰੀ ਕਰਨ ਲਈ ਥੋੜ੍ਹਾ ਆਪਣਾ ਇੰਜੋਏਮੈਂਟ ਵਾਸਤੇ ਬਾਹਰ ਚੱਲੇ ਜਾਂਦੇ ਹਾਂ ਅਤੇ ਇੰਜੋਏਮੈਂਟ ਕਰਦੇ ਹਾਂ ਅਤੇ ਥੋੜ੍ਹਾ ਜਿਹਾ ਸਕਰੀਨ ਤੋਂ ਪਰਾਂ ਹਟ ਕੇ ਥੋੜ੍ਹਾ ਸਿਸਟਮ ਤੋਂ ਸਾਈਡ ਹੋ ਕੇ ਆਪਣਾ ਵਧੀਆ ਲੱਗਦਾ ਹੈ ਕਿ ਅਸੀਂ ਤਾਜ਼ੀ ਹਵਾ ਵਿੱਚ ਜਾ ਕੇ ਆਪਣੇ ਆਪ ਨੂੰ ਫਰੀ ਮਾਇੰਡ ਕਰਦੇ ਹਾਂ ਕਿ ਸਾਰਾ ਥੋੜ੍ਹੀ ਦੇਰ ਵਾਸਤੇ ਸਭ ਕੁਛ ਸਾਈਡ 'ਤੇ ਕਰਕੇ ਅਸੀਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਰਿਲੈਕਸ ਫੀਲ ਕਰਾਈਏ ਅਤੇ ਵਧੀਆ ਵੀ ਲੱਗਦਾ ਹੈ ਕਿ ਬਾਕੀ ਸਕਰੀਨ ਦੇ ਉੱਤੇ ਕੰਮ ਕਰਕੇ ਅਤੇ ਕੰਮ ਤਾਂ ਕਰਨਾ ਹੀ ਪੈਂਦਾ ਹੈ ਬਾਕੀ ਇਹ ਹੈ ਕਿ ਬੋਰੀਅਤ ਹੋਵੇ ਚਾਹੇ ਜੋ ਮਰਜ਼ੀ ਹੋਵੇ ਬਾਕੀ ਅਸੀਂ ਕੰਮ ਕਰਕੇ ਉਸ ਤੋਂ ਬਾਅਦ ਅਸੀਂ ਇੰਜੋਏ ਵੀ ਕਰਦੇ ਹਾਂ ਅਤੇ ਰਿਲੈਕਸ ਫੀਲ ਵੀ ਕਰਦੇ ਹਾਂ